ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਜੀ ਪਲੇਟ ਦੇ ਵਿੱਚ ਨੋਨ ਵੈੱਜ ਵੈੱਜ ਕਿੱਦਾਂ ਦੀਆਂ ਤੁਸੀਂ ਕਰਨੀ ਹੈ ਜੀ ਸਰ ਹਾਂਜੀ ਕਿੱਦਾਂ ਦੀ ਤੁਸੀਂ ਥਾਲੀ ਲੈਣੀ ਆ ਨੋਨ ਵੈੱਜ ਲੈਣੀ ਆ ਵੈੱਜ ਲੈਣੀ ਆ ਕਿੱਦਾਂ ਦੀ ਤਿਆਰ ਕਰਵਾਉਣੀ ਆ ਥਾਲੀ ਦੇ ਵਿੱਚ ਜੇ ਤੁਸੀਂ ਸਿੰਪਲ ਲੈਣੀ ਆ ਜੀ ਜੀ ਪ੍ਰਸ਼ਾਦਾ ਬ ਚੌਲ ਜੀ ਅਤੇ ਸਵੇਰੇ ਹੋਣਗੇ ਜੀ ਦਹੀਂ ਹੋਏਗਾ ਦੋ ਸਬ ਏ ਦੋ ਸਬਜ਼ੀਆਂ ਹੋਣਗੀਆਂ ਜੀ ਇੱਕ ਮਿਕਸ ਹੋਏਗੀ ਇੱਕ ਦਾਲ ਹੋਏਗੀ ਮਿੱਠਾ ਤੁਸੀਂ ਦੇਖੋ ਜੀ ਜਾਂ ਤਾਂ ਗੁਲਾਬ ਜਾਮਣ ਲੈਣੀ ਆ ਜਾਂ ਫਿਰ ਗਾਜਰਪਾਕ ਜੋ ਵੀ ਤੁਸੀਂ ਕਹੋਗੇ ਹੈਂਜੀ ਉਹ ਵੀ ਹੋਏਗਾ ਹੀ ਜੀ ਬਿਲਕੁਲ ਹਾਂਜੀ ਜੀ ਠੀਕ ਹੈ ਜੀ ਹਾਂਜੀ ਸਵੇਰੇ ਇੱਕ ਨਾ ਜੋ ਚਾਹ ਦੇ ਨਾਲ ਹੋਏਗਾ ਉਹ ਦੇਖ ਲਓ ਪਕੌੜੇ ਹੋਣਗੇ ਦੋ ਤਿੰਨ ਟੈਪ ਦੇ ਠੀਕ ਹੈ ਜੀ ਅਤੇ ਨਾਲ ਜੋ ਵੀ ਹੈ ਤਾਂ ਜਿਸ ਤਰ੍ਹਾਂ ਓਹ ਜੀ ਤੁਸੀਂ ਹੋਰ ਐਟਮ ਕਰਵਾਉਣੀ ਹੋਵੇ ਤਾਂ ਉਹ ਵੀ ਦੱਸ ਦਿਓ ਹਾਂਜੀ ਹਾਂ ਬਾਕੀ ਦੋ ਤਿੰਨ ਤਰ੍ਹਾਂ ਦੇ ਤਿੰਨ ਤਰ੍ਹਾਂ ਦੀ ਮਠਿਆਈ ਹੋਵੇਗੀ ਸਵੇਰੇ

ਹਾਂਜੀ ਹਾਂ ਕੋਈ ਗੱਲ ਨਹੀਂ ਜਦੋਂ ਤੁਸੀਂ ਜਦ ਜਿੰਨੀ ਵੀ ਹੋ ਸਕਦਾ ਤੁਸੀਂ ਮੈਨੂੰ ਦੱਸ ਦਿਓ ਮੈਂ ਕਰਕੇ ਔਡਰ ਕਰਵਾ ਦਾਂਗਾ